ਹੈਲੋ ਮੈਂ ਰਮਨਪ੍ਰੀਤ ਕੌਰ ਗੱਲ ਕਰ ਰਹੀ ਹਾਂ ਕੀ ਮੈਂ ਮੀਸ਼ੋ ਕਸਟਮਰ ਕੇਅਰ ਨਾਲ ਗੱਲ ਕਰ ਰਹੀ ਹਾਂ ਐਕਚੁਲੀ ਮੈਂ ਇੱਕ ਸੂਟ ਔਡਰ ਕੀਤਾ ਸੀ ਜਿਸ ਦੀ ਡਿਲੀਵਰੀ ਸੱਤ ਦਿਨ ਬਾਅਦ ਦੀ ਸੀ ਪਰ ਉਹ ਸੂਟ ਮੈਨੂੰ ਪੂਰੇ ਦਸ ਦਿਨ ਬਾਅਦ ਡਿਲੀਵਰ ਹੋਇਆ ਸੂਟ ਦੇਖਣ ਵਿੱਚ ਬਹੁਤ ਵਧੀਆ ਸੀ ਐਂਡ ਮੈਨੂੰ ਬਹੁਤ ਪਸੰਦ ਆਇਆ ਉਹਦਾ ਕਲਰ ਵੀ ਬਹੁਤ ਠੀਕ ਸੀ ਪਰ ਜ ਉਹ ਮੈਂ ਪਾ ਕੇ ਦੇਖਿਆ ਤਾਂ ਮੈਨੂੰ ਥੋੜ੍ਹਾ ਲੂਜ ਫੀਲ ਹੋਇਆ ਕਿ ਮੈਨੂੰ ਫਿਟਿੰਗ ਨਹੀਂ ਸੀ ਫਿਰ ਮੈਂ ਉਹਨੂੰ ਆਪਣੇ ਅਕੋਰਡਿੰਗ ਫਿੱਟ ਕੀਤਾ ਤਾਂ ਜਦੋਂ ਮੈਂ ਪਾ ਕੇ ਐਡ ਉਸ ਨੂੰ ਫਿਰ ਦੇਖਿਆ ਤਾ ਉਸ ਤੋਂ ਥੋੜ੍ਹਾ ਥੋੜ੍ਹਾ ਕਲਰ ਉਤਰ ਰਿਹਾ ਸੀ ਐਂਡ ਜਦੋਂ ਮੈਂ ਉਹਨੂੰ ਧੋਤਾ ਤਾਂ ਉਹਦਾ ਕਲਰ ਬਿਲਕੁਲ ਹੀ ਖ਼ਰਾਬ ਹੋ ਗਿਆ ਐਂਡ ਉਹਨੂੰ ਦੇਖ ਕੇ ਮੇਰਾ ਮਨ ਬਿਲਕੁਲ ਹੀ ਉਦਾਸ ਹੋ ਗਿਆ ਮੈਂ ਉਹ ਸੂਟ ਆਪਣੀ ਇੱਕ ਫੰਕਸ਼ਨ ਵਾਸਤੇ ਲਿਆ ਸੀ ਅਤੇ ਹੁਣ ਉਹ ਸੂਟ ਇੰਨਾ ਨਾਲ ਖ਼ਰਾਬ ਹੋ ਗਿਆ ਹੈ ਤਾਂ ਉਹਦਾ ਕਰਕੇ ਮੈਂ ਆਪਣੀ ਉਸ ਫੰਕਸ਼ਨ 'ਤੇ ਉਸਨੂੰ ਪਾ ਵੀ ਨਹੀਂ ਸਕਦੀ ਹੁਣ ਮੈਨੂੰ ਉਹ ਆਪਣੇ ਫੰਕਸ਼ਨ ਵਾਸਤੇ ਇੱਕ ਹੋਰ ਸੂਟ ਲੈਣਾ ਪਵੇਗਾ ਜਿਹਦੇ ਕਰਕੇ ਮੇਰੇ ਟਾਈਮ ਅਤੇ ਮੇਰੀ ਮਨੀ ਦੋਵੇਂ ਹੀ ਵੇਸਟ ਹੋਇਆ ਮੈਨੂੰ ਹੁਣ ਬਹੁਤ ਅਪਸੈਟ ਫੀਲ ਹੋ ਰਿਹਾ ਹੈ ਮੈਂ ਇੱਕ ਗੁੱਡ ਐਕਸਪੀਰੀਅੰਸ ਨਹੀਂ ਕੀਤਾ ਤੋ ਮੈਨੂੰ